ਸਤਿ ਸ਼੍ਰੀ ਅਕਾਲ ਜੀ ਤੁਸੀਂ ਸਵੀਗੀ ਤੋਂ ਗੱਲ ਕਰ ਰਹੇ ਹੋ ਪਿਛਲੇ ਕੁਝ ਦਿਨ ਪਹਿਲਾਂ ਅਸੀਂ ਬਰਾੜ ਰੈਸਟੋਰੈਂਟ ਤੋਂ ਖਾਣ ਪੀਣ ਵਾਲਾ ਬਹੁਤ ਸਾਰਾ ਸਮਾਨ ਮੰਗਵਾਇਆ ਜਿਵੇਂ ਪੀਜਾ ਬਰਗਰ ਕੋਲਡ ਡਰਿੰਕਸ ਫਰੈਂਚ ਫਰਾਈ ਇਸ ਬਹੁਤ ਜ਼ਿਆਦਾ ਸਵਾਦਿਸ਼ਟ ਸੀਗੇ ਅਤੇ ਔਡਰ ਕਰਨ ਤੋਂ ਬਾਅਦ ਔਡਰ ਕਰਨ 'ਤੇ ਇਹਨਾਂ ਨੇ ਸਾਨੂੰ ਤੀਹ ਪਰਸੈਂਟ ਛੋਟ ਦਿੱਤੀ ਹੁਣ ਅਸੀਂ ਇਹ ਚੀਜ਼ਾਂ ਦੁਬਾਰ ਫਿਰ ਤੋਂ ਔਡਰ ਕਰਨੀਆਂ ਨੇ ਜਿਵੇਂ ਕੋਲਡ ਡਰਿੰਕ ਪੀਜਾ ਬਰਗਰਸ 'ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਜਿਹੜਾ ਤੀਹ ਪਰਸੈਂਟ ਦਾ ਕੁਪਨ ਡਿਸਕਾਊਂਟ ਦਿੱਤਾ ਸੀਗਾ ਉਹ ਤੁਸੀਂ ਉਹ ਉਸ ਉਹ ਸਾਡਾ ਰੀ ਰੀਡੀਮ ਕੀਤਾ ਜਾਵੇ ਤਾਂ ਜੋ ਅਸੀਂ ਇਸ ਚੀਜ਼ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕੀਏ ਬਾਕੀ ਤੁਹਾਡਾ ਸਮਾਨ ਬਹੁਤ ਜ਼ਿਆਦਾ ਸਵਾਦਿਸ਼ਟ ਸਵਾਦਿਸ਼ਟ ਹੈ